ਖੇਡਾਂ ਤਾਂ ਵੈਸੇ ਅਸੀਂ ਬਹੁਤ ਸਾਰੀਆਂ ਖੇਡਦੇ ਹਾਂ ਜਿਵੇਂ ਇਨਡੋਰ ਖੇਡਾਂ ਹੁੰਦੀਆਂ ਆਊਟਡੋਰ ਖੇਡਾਂ ਹੁੰਦੀਆਂ ਘਰ ਬਹਿਣ ਵਾਲੀਆਂ ਕੈਰਮਬੋਟ ਹੋ ਗਿਆ ਲੁੱਡੋ ਹੋ ਗਈ ਅਤੇ ਬਾਹਰ ਦੀਆਂ ਖੇਡਾਂ ਅਸੀਂ ਟਿਊਸ਼ਨ 'ਤੇ ਬਹੁਤ ਖੇਡਦੇ ਹੁੰਦੇ ਸੀ ਚਿੜੀ ਛਿੱਕਾ ਹੋ ਗਿਆ ਬਾਂਦਰ ਕਿੱਲਾ ਹੋ ਗਿਆ ਗਾਲੜ੍ਹੀ ਹੋ ਗਈ ਸਟੈਪੂ ਹੋ ਗਿਆ ਠੰਡਾ ਪਾਣੀ ਮਿੱਠਾ ਪਾਣੀ ਹੋ ਗਿਆ ਊਚ ਨੀਚ ਦਾ ਪਾਪੜਾ ਹੋ ਗਿਆ ਪਰ ਉਹ ਉਹਨੂੰ ਅੱਜ ਕੱਲ੍ਹ ਜ਼ਿਆਦਾ ਤਾਂ ਅਸੀਂ ਬੱਸ ਹਜੇ ਤਾਂ ਕੈਰਮਬੋਟ ਜਾਂ ਚਿੜੀ ਛਿੱਕਾ ਹੀ ਖੇਡਦੇ ਹਾਂ ਲੋਕਾਂ ਨੇ ਉਹ ਥਾਂ ਸਾਡਾ ਇੱਕ ਪਿੰਡ 'ਚ ਗਰਾਊਂਡ ਦੋ ਗਰਾਉਂਡ ਬਣੇ ਹੋਏ ਆ ਇੱਕ ਪਿੰਡ ਦੇ ਪਿੱਛੇ ਅਤੇ ਇੱਕ ਪਿੰਡ ਦੇ ਅੱਗੇ ਬੱਚਿਆਂ ਨੂੰ ਉੱਥੇ ਖੇਡਦੇ ਆ ਉੱਥੇ ਹੌਕੀ ਖੇਡਦੇ ਨੇ ਨਿਆਣੇ ਅਤੇ ਅਸੀਂ ਜਿਹੜੀ ਗੇਮ ਖੇਡਦੇ ਹਾਂ ਚਿੜੀ ਛਿੱਕਾ ਉਹ 'ਚ ਬਹੁਤ ਮਜ਼ਾ ਆਉਂਦਾ ਮੇਰੀ ਭੈਣ ਅਤੇ ਮੈਂ ਖੇਡਦੇ ਹਾਂ ਮੈਂ ਆਪਣੀ ਭੈਣ ਨਾਲ ਖੇਡਦੀ ਹੁੰਦੀ ਹਾਂ ਅਤੇ ਆਹ ਸਾਡੇ ਪਿੰਡ 'ਚ ਵੀ ਕਾਫ਼ੀ ਬੱਚੇ ਨੇ ਜਿਹੜੇ ਕ੍ਰਿਕਟ ਹਾਕੀ ਖੇਡਦੇ ਹੈ ਹੈ ਤਾਂ ਗਰਾਉਂਡ ਚਿੜੀ ਛਿੱਕੇ ਲਈ ਵੀ ਹੈ ਉੱਥੇ ਪਰ ਜ਼ਿਆਦਾਤਰ ਵੀ ਮੁੰਡੇ ਜਿਹੜੇ ਸਾਡੇ ਪਿੰਡ ਦੇ ਆ ਉਹ ਹਾਕੀ ਜਾਂ ਕ੍ਰਿਕਟ ਖੇਡਦੇ ਆ ਸਾਡੇ ਉੱਥੇ ਹਾਕੀ ਦੇ ਟੂਰਨਾਮੇਂਟ ਵੀ ਹੁੰਦੇ ਆ ਕ੍ਰਿਕਟ ਦੇ ਵੀ ਟੂਰਨਾਮੈਂਟ ਹੁੰਦੇ ਆ ਮੇਰੇ ਖੁਦ ਦੇ ਭਾਜੀ ਕੈਪਟਨ ਰਹਿ ਚੁੱਕੇ ਨੇ ਉਹ ਹੋਕੀ ਟੀਮ ਦੇ ਹੁਣ ਉਹ ਕੋਚ ਨੇ ਅਤੇ ਇਸ ਤਰ੍ਹਾਂ ਬਹੁਤ ਮਜ਼ਾ ਆਉਂਦਾ ਦੇਖ ਕੇ ਕਿ ਹਾਂ ਸਾਡੇ ਪਿੰਡ 'ਚ ਵਿਕਾਸ ਹੋਣ ਡਿਆ ਆ ਹਾਲਾਂਕਿ ਹਜੇ ਇੰਨਾ ਕੁ ਨਹੀਂ ਹੋਇਆ ਪਰ ਠੀਕ ਹੈ ਜਿੰਨਾਂ ਕੁ ਬੱਚਿਆਂ ਨੂੰ ਚਾਹੀਦਾ ਵਿਚਾਰੇ ਲੱਗੇ ਰਹਿੰਦੇ ਹਨ ਸ਼ਾਮ ਉਹਨਾਂ ਨੇ ਸਕੂਲੋਂ ਆਉਣਾ ਆ ਸ਼ਾਮ ਉਹਨਾਂ ਨੇ ਟਿਊਸ਼ਨ ਪੜ੍ਹ ਕੇ ਆਪਣੀ ਖੇਡਣ ਵੱਲ ਦੌੜ ਜਾਣਾ ਕਿ ਨਸ਼ਿਆਂ 'ਚ ਨਹੀਂ ਲਗਾਏ ਬੱਚੇ ਉਹਨਾਂ ਨੇ ਖੇਡਣ 'ਚ ਲਾਏ ਆ ਸਾਡੀ ਸਰਕਾਰ ਨੇ ਚਿੜੀ ਛਿੱਕਾ ਖੇਡਦੇ ਵੇਲੇ ਮੇਰੀ ਅਤੇ ਮੇਰੀ ਭੈਣ ਦੀ ਬਹੁਤ ਲੜਾਈ ਹੁੰਦੀ ਆ ਅਸੀਂ ਹਮੇਸ਼ਾ ਲੜਦੇ ਰਹਿੰਦੇ ਨੇ ਖੇਡਣ ਵੇਲੇ ਚਿੜੀ ਛਿੱਕੇ ਨਾਲ ਇਹ ਹੁੰਦਾ ਕਿ ਮਨ ਡਾਈਵਰਟ ਨਹੀਂ ਹੁੰਦਾ ਕਿਤੇ ਜੇ ਤੁਸੀਂ ਟਾਈਮ ਸਟੋਟ 'ਤੇ ਕੁਛ ਖੇਡਦੇ ਹੋ ਤੁਹਾਡਾ ਉਹਦੇ ਨਾਲ ਮਨ ਸ਼ਾਂਤ ਹੁੰਦਾ ਜਾਂ ਉਸ ਚੀਜ਼ ਤੋਂ ਹੱਟ ਜਾਂਦਾ ਆ ਉਹ ਪ੍ਰੋਬਲਮ ਥੋੜ੍ਹੀ ਦੇਰ ਲਈ ਟਲ ਜਾਂਦੀ ਹੈ ਇੱਕ ਛੇ ਸਾਲ 'ਚ ਤੁਸੀਂ ਵੱਡੇ ਹੋ ਕੇ ਚਿੜੀ ਛਿੱਕਾ ਲੈਂਦੇ ਹੋ ਤੁਹਾਨੂੰ ਇੱਕ ਫੀਲ ਹੁੰਦਾ ਹੈ ਵੀ ਅਸੀਂ ਨਿੱਕੇ ਹੁੰਦੇ ਕਿੱਦਾਂ ਖੇਡਦੇ ਸੀ ਅਸੀਂ ਆਪਣੀ ਟਿਊਸ਼ਨ ਦੇ ਬੜੇ ਮਜ਼ੇ ਕੀਤੇ ਦੇ ਆ ਟਿਊਸ਼ਨ 'ਤੇ ਅਸੀਂ ਹਮੇਸ਼ਾ ਸਾਰੇ ਬੱਚਿਆ ਨੇ ਛੇਤੀ ਛੇਤੀ ਕੰਮ ਮੁਕਾ ਕੇ ਡੇਢ ਘੰਟੇ 'ਚ ਕੰਮ ਮੁਕਾ ਕੇ ਆਪਣਾ ਗਾਲੜ੍ਹੀ ਖੇਡਣੀ ਚਿੜੀ ਛਿੱਕਾ ਖੇਡਣਾ ਕੈਰਮਬੋਟ ਖੇਡਣਾ ਬਾਂਦਰ ਕਿੱਲੇ 'ਚ ਤਾਂ ਅਸੀਂ ਇੰਨਾਂ ਮਜ਼ਾ ਪਾਈਦਾ ਨਾ ਬੜਾ ਬਾਂਦਰ ਕਿੱਲਾ ਖੇਡਦੇ ਹੁੰਦੇ ਸੀ ਅਸੀਂ

ਚਿੜੀ ਛਿੱਕੇ 'ਚ ਇਹ ਆ ਕਿ ਮੈਂ ਚਿੜੀ ਛਿੱਕਾ ਤਾਂ ਖੇਡਦੀ ਕਿਉਂਕਿ ਮੈਨੂੰ ਲੱਗਦਾ ਕਿ ਉਹਦੇ ਨਾਲ ਮੇਰੀ ਹਾਈਟ ਵੱਧ ਜਾਣੀ ਆ ਲੰਮੀ ਹੋ ਹੋ ਕੇ ਚਿੜੀ ਛਿੱਕਾ ਖੇਡਣਾ ਚਿੜੀ ਬੜੀ ਦੂਰ ਤੱਕ ਮਾਰਨੀ ਪੈਂਦੀ ਬੜਾ ਮਜ਼ਾ ਆਉਂਦਾ ਹੁੰਦਾ ਸੀ ਇਹ ਚਿੜੀ ਛਿੱਕਾ ਖੇਡਣ ਦਾ ਅਤੇ ਕੁਝ ਯਾਦਾਂ ਜੁੜੀਆਂ ਹੁੰਦੀਆਂ ਸਾਡੀਆਂ